ਸਾਡੇ ਪੰਜਾਬ ਵਿੱਚ ਬਹੁਤ ਹੀ ਵਧੀਆ ਤਰ੍ਹਾਂ ਦੇ ਪਕਵਾਨ ਪਕਾਏ ਜਾਂਦੇ ਹਨ ਪਰ ਜਿਹੜੇ ਸਿਹਤਮੰਦ ਪਕਵਾਨ ਹਨ ਜਿਵੇਂ ਕਿ ਦੁੱਧ ਦਹੀਂ ਲੱਸੀ ਮੱਖਣ ਘਿਓ ਪੰਜੀਰੀ ਪਿੰਨੀ ਅਤੇ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਜੋ ਕਿ ਸਭ ਤੋ ਜ਼ਿਆਦਾ ਪ੍ਰਸਿੱਧ ਪਕਵਾਨ ਹਨ ਸਾਡੇ ਪੰਜਾਬ ਦੇ ਅਤੇ ਦੂਰ ਦੂਰ ਤੋਂ ਲੋਕੀ ਇਸ ਪਕਵਾਨ ਨੂੰ ਖਾਣ ਵਾਸਤੇ ਆਉਂਦੇ ਹਨ ਅਤੇ ਜਿਹੜਾ ਵੀ ਕੋਈ ਖਾ ਕੇ ਜਾਂਦਾ ਹੈ ਉਹ ਹਰੇਕ ਕੋਈ ਇਸ ਦੀ ਬਹੁਤ ਜ਼ਿਆਦਾ ਤਾਰੀਫ ਕਰਦਾ ਹੈ ਕਿਉਂਕਿ ਇਹ ਇਹੋ ਜਿਹੇ ਪਕਵਾਨ ਹਨ ਜੋ ਕਿ ਸਿਰਫ ਸਾਡੇ ਪੰਜਾਬ ਦੇ ਵਿੱਚ ਹੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਔਰ ਜਿਹੜਾ ਉਹਨਾਂ ਦਾ ਟੇਸਟ ਹੁੰਦਾ ਜਿਹੜਾ ਉਹਨਾਂ ਦਾ ਸਵਾਦ ਹੁੰਦਾ ਉਹ ਸਿਰਫ ਤੁਹਾਨੂੰ ਸਾਡੇ ਪੰਜਾਬ ਵਿੱਚ ਹੀ ਮਿਲ ਸਕਦਾ ਕਿਤੇ ਹੋਰ ਉਵੇਂ ਦਾ ਸਵਾਦ ਤੁਹਾਨੂੰ ਨਹੀਂ ਮਿਲ ਸਕਦਾ